ਖ ਵੱਖ ਵੱਖ ਬਰਾਂਡਾ ਦੇ ਟੈਲੀਫੋਨ ਇਸਤੇਮਾਲ ਕਰਦੇ ਹਨ ਬਹੁਤ ਲੋਕਾਂ ਕੋਲ ਕਿਸੇ ਕੋਲ ਰੈਡਮੀ ਸੋਨੀ ਸੈਮਸੰਗ ਪੋਕੋ ਆਦਿ ਬਹੁਤ ਹੀ ਬ੍ਰਾਂਡਾਂ ਦੇ ਫੋਨ ਹਨ ਜ਼ਿਆਦਾਤਰ ਮੇਰੇ ਤੋਂ ਵੀ ਰੈਡਮੀ ਦਾ ਹੀ ਫੋਨ ਹੈ ਅਤੇ ਮੈਨੂੰ ਇਹ ਬਰਾਂਡ ਬਹੁਤ ਹੀ ਵਧੀਆ ਲੱਗਦਾ ਹੈ ਇਸ ਇਹ ਬ੍ਰਾਂਡ ਬੜੇ ਹੀ ਵਧੀਆ ਤਰੀਕੇ ਨਾਲ ਆਪਣਾ ਕੰਮ ਕਰਦਾ ਹੈ ਅਤੇ ਇਸ ਦਾ ਕੈਮਰਾ ਬਹੁਤ ਹੀ ਵਧੀਆ ਹੈ ਨੋਟਸ ਫੋਟੋਜ਼ ਕਲਿੱਕ ਕਰਨ ਲਈ ਬਹੁਤ ਹੀ ਕਲੈਰਿਟੀ ਆਦਿ ਦਿੰਦਾ ਹੈ ਅਤੇ ਇਸ ਵਿੱਚ ਅਸੀਂ ਸਟਡੀ ਲਈ ਪੜ੍ਹਨ ਲਈ ਕੋਈ ਕਿਸੇ ਵੀ ਤਰ੍ਹਾਂ ਦੀ ਵੀਡੀਓਜ਼ ਵਗੈਰਾ ਦੇਖ ਸਕਦੇ ਹਾਂ ਇਹ ਮੇਰੇ ਲਈ ਬਹੁਤ ਹੀ ਜ਼ਿਆਦਾ ਹੈਲਪਫੁਲ ਹੈ ਅਤੇ ਮੈਂ ਆਪਣੇ ਫੋਨ ਦੇ ਇਸ ਬ੍ਰਾਂਡ ਤੋਂ ਬਹੁਤ ਹੀ ਜ਼ਿਆਦਾ ਸੰਤੁਸ਼ਟ ਹਾਂ ਮੈਨੂੰ ਇਹ ਚੰਗਾ ਲੱਗਦਾ ਹੈ ਇਸ ਵਿੱਚ ਅਸੀਂ ਮੈਂ ਇਸ ਵਿੱਚ ਮੈਂ ਬਹੁਤ ਤਰ੍ਹਾਂ ਦੀ ਮਦਦ ਲਈ ਚੀਜ਼ਾਂ ਦੇਖੀਆਂ ਹਨ ਆਨਲਾਈਨ ਚੀਜ਼ਾਂ ਵੀ ਮੰਗਵਾਈਆਂ ਹਨ ਇਹ ਬਹੁਤ ਹੀ ਵਧੀਆ ਹੈ